ਸਤਿ ਸ਼੍ਰੀ ਅਕਾਲ ਹੈਂਡਮੇਡ ਕਲੋਥ ਅਤੇ ਰੈਡੀਮੇਡ ਕਲੋਥ ਵਿੱਚ ਕਈ ਫ਼ਰਕ ਹੁੰਦੇ ਆ ਅਤੇ ਲੋਕ ਆਪਣੀ ਸੋਚ ਅਤੇ ਵਿਚਾਰ ਦੇ ਅਨੁਸਾਰ ਲੈਂਦੇ ਹੈਗੇ ਆ ਜੋ ਹੈਂਡਮੇਡ ਕਲੋਥ ਹੈਗੇ ਉਹ ਕ੍ਰੀਏਟਿਵਿਟੀ ਅਤੇ ਮਿਹਨਤ ਦਾ ਨਤੀਜਾ ਹੁੰਦਾ ਕਈ ਸਾਰੇ ਲੋਕ ਦਸ ਦਸ ਦਿਨ ਵੀਹ ਵੀਹ ਦਿਨ ਲੈ ਕੇ ਇੱਕ ਉੱਨ ਨੂੰ ਲੈਂਦੇ ਆ ਅਤੇ ਉੱਨ ਨੂੰ ਬਣਾ ਬਣਾ ਕੇ ਇੱਕ ਬਹੁਤ ਸੁੰਦਰ ਸਵੈਟਰ ਬਣਾਉਂਦੇ ਹੈਗੇ ਆ ਅਤੇ ਉੱਥੇ ਰੈਡੀਮੇਡ ਕਲੋਥ ਜੋ ਕਿ ਦਸ ਮਿੰਟ ਅਤੇ ਪੰਜ ਮਿੰਟ 'ਚ ਬਣ ਜਾਂਦਾ ਹੈਗਾ ਹੈ ਅਤੇ ਇਸੇ ਕਾਰਣ ਲੋਕ ਹੈਂਡਮੇਡ ਕਲੋਥ ਨੂੰ ਜ਼ਿਆਦਾ ਲੈਣ ਦੀ ਕੋਸ਼ਿਸ਼ ਕਰਦੇ ਕਿਉਂਕਿ ਇੱਕ ਉਹਨਾਂ ਨੇ ਇਹ ਵਿਰਾਸਤ ਦਾ ਰੂਪ ਦਿਖਾਉਂਦਾ ਹੈ ਕਿ ਇਹ ਸਾਡੀ ਵਿਰਾਸਤ ਹੈਗੀ ਆ ਪਹਿਲਾਂ ਦੇ ਜ਼ਮਾਨੇ 'ਚ ਲੋਕ ਇੱਦਾਂ ਸਮਾਨ ਲੈਂਦੇ ਸੀ ਅਤੇ ਅਸੀਂ ਹੁਣ ਵੀ ਆਪਾਂ ਇੱਦਾਂ ਦੇ ਹੀ ਸਮਾਨ ਲਈਏ ਕਹਿ ਸਕਦੇ ਹਾਂ ਕੀ ਕਿ ਇਹ ਫੈਸ਼ਨ ਦਾ ਰੂਪ ਵੀ ਬਣ ਗਿਆ ਹੈ ਇਹ ਹੈਂਡਮੇਡ ਕਲੋਥਸ ਲੈਣ ਦਾ ਲੋਕ ਅੱਜ ਕੱਲ੍ਹ ਬਹੁਤ ਜ਼ਿਆਦਾ ਮਹਿੰਗੇ ਕੱਪੜੇ ਮਿਲਦੇ ਆ ਹੈਂਡਮੇਡ ਜਿਵੇਂ ਕਿ ਫੁਲਕਾਰੀ ਅਜਰਖ ਅਤੇ ਹੈਂਡਲੂਮ ਦੀ ਬਣਾਈਆਂ ਗਈਆਂ ਕੱਪੜੇ ਲੋਕ ਬਹੁਤ ਜ਼ਿਆਦਾ ਲੈਂਦੇ ਆ ਅਤੇ ਕਈ ਜ਼ਿਆਦਾ ਮਹਿੰਗੇ ਆਉਂਦੇ ਆ ਉੱਥੇ ਹੀ ਰੈਡੀਮੇਡ ਕਲੋਥ ਇਹ ਕਈ ਤਰੀਕੇ ਇਹਦੇ ਨਾਲ ਦੇ ਕਿੰਨੇ ਕਲਰ ਅਤੇ ਡਿਜ਼ਾਇਨ ਬਾਜ਼ਾਰ ਵਿੱਚ ਉਪਲੱਬਧ ਹੁੰਦੇ ਅਤੇ ਲੋਕ ਆਪਣੇ ਪਸੰਦ ਦੇ ਅਨੁਸਾਰ ਲੈਂਦੇ ਹੈਗੇ ਆ ਇਹ ਬਹੁਤ ਸਸਤੇ ਵੀ ਆਉਂਦੇ ਆ ਪਰ ਇਹ ਪਰਿਆਵਰਨ ਲਈ ਨੁਕਸਾਨਦਾਇਕ ਵੀ ਹੁੰਦੇ ਆ ਜਦੋਂ ਇਹਨਾਂ ਨੂੰ ਖ਼ਤਮ ਕੀਆ ਜਾਂਦਾ ਹੈ ਜਾਂ ਡੀਕੰਪੋਜ਼ ਕੀਆ ਜਾਂਦਾ ਹੈ ਇਹ ਕਦੀ ਵੀ ਖ਼ਤਮ ਨਹੀਂ ਹੋ ਜਾਂਦੇ ਬਲਕਿ ਸਾਡੇ ਪਰਿਆਵਰਨ ਨੂੰ ਨੁਕਸਾਨ ਪਹੁੰਚਾਉਂਦੇ ਆ ਉੱਥੇ ਹੀ ਹੈਂਡਮੇਡ ਕਲੋਥ ਪਰਿਆਵਰਨ ਨੂੰ ਨੁਕਸਾਨ ਨਹੀਂ ਪਹੁੰਚਾਉਂਦੇ ਆ ਅੱਜ ਕੱਲ੍ਹ ਲੋਕ ਬੋਰੀ ਦੇ ਕੱਪੜੇ ਬਣਾਉਣ ਵੱਲ ਲੱਗ ਗਏ ਆ ਬੋਰੀ ਦੇ ਅ ਬੈਗ ਲੈ ਕੇ ਜਾਣ ਲੱਗ ਗਏ ਆ ਬਾਜ਼ਾਰਾਂ 'ਚ ਤਾਂ ਕਿ ਉਹ ਪਰਿਆਵਰਨ ਅਕੋਰਡਿੰਗ ਹੋਵੇ ਪਰਿਆਵਰਨ ਫਰੈਂਡਲੀ ਹੋਵੇ ਧੰਨਵਾਦ ਜੀ